ਜਦੋਂ ਮੈਂ ਉਸ ਬੂਟਾਂ ਦੇ ਜੋੜੇ ਨੂੰ ਧੋਇਆ ਤਾਂ ਉਹਦਾ ਕੱਪੜਾ ਬਿਲਕੁਲ ਖ਼ਰਾਬ ਹੋ ਗਿਆ ਪਰ ਜਦੋਂ ਕਿ ਐਪ ਦੇ ਵਿੱਚ ਲਿਖਿਆ ਹੋਇਆ ਸੀ ਕਿ ਇਹ ਧੋ ਬੂਟ ਧੋਣ ਦੇ ਲਾਇਕ ਹਨ ਅਤੇ ਇਹ ਬਿਲਕੁਲ ਵੀ ਖ਼ਰਾਬ ਨਹੀਂ ਹੋਣਗੇ ਪਰ ਫਿਰ ਵੀ ਅਜਿਹਾ ਹੋਇਆ